ਮੈਂ ਆਪਣਾ ਊਬਰ ਨਾਲ ਰੀਸੈਂਟ ਐਕਪੀਰੀਅਸ ਸ਼ੇਅਰ ਕਰਨਾ ਚਾਹਾਵਾਂਗਾ ਕੱਲ੍ਹ ਰਾਤੀਂ ਮੈਂ ਦਿੱਲੀ ਤੋਂ ਰੋਪੜ ਟਰੇਨ ਰਾਹੀਂ ਆਇਆ ਰੋਪੜ ਪਹੁੰਚਿਆ ਰਾਤੀਂ ਗਿਆਰਾਂ ਵਜੇ ਦੇ ਕਰੀਬ ਮੈਂ ਰੋਪੜ ਪਹੁੰਚਿਆ ਅਤੇ ਉਸ ਤੋਂ ਬਾਅਦ ਮੈਂ ਨਵਾਸ਼ਹਿਰ ਆਪਣੇ ਘਰ ਜਾਣਾ ਸੀਗਾ ਪਰ ਰਾਤੀਂ ਲੇਟ ਗਿਆਰਾਂ ਵਜੇ ਕਾਫ਼ੀ ਦੇਰ ਰਾਤ ਹੋਣ ਕਾਰਨ ਮੈਨੂੰ ਕੋਈ ਬੱਸ ਨਹੀਂ ਮਿਲੀ ਅਤੇ ਫਿਰ ਮੈਂ ਸੋਚਿਆ ਕਿ ਔਨਲਾਈਨ ਰਾਈਡਿੰਗ ਕੈਬ ਊਬਰ ਦਾ ਯੂਜ਼ ਕਰਾਂ ਅਤੇ ਫਿਰ ਜਦੋਂ ਮੈਂ ਊਬਰ ਯੂਜ਼ ਕੀਤਾ ਤਾਂ ਇਹ ਮੈਨੂੰ ਇੱਕ ਡਰਾਈਵਰ ਕਾਫ਼ੀ ਘੱਟ ਸਮੇਂ ਵਿੱਚ ਹੀ ਪੰਜ ਸਮੇਂ ਪੰਜ ਮਿੰਟ ਦੇ ਵਿੱਚ ਵਿੱਚ ਹੀ ਐਕਸੈਪਟੇਂਸ ਆ ਗਈ ਰਾਜਵੀਰ ਨਾਮ ਦਾ ਡਰਾਈਵਰ ਸੀ ਉਸ ਨੇ ਫਿਰ ਮੈਨੂੰ ਜ਼ਲਦੀ ਪਿਕਅੱਪ ਅੱਪ ਕਰ ਲਿਆ ਟਰੇਨ ਸਟੇਸ਼ਨ ਤੋਂ ਡਰਾਈਵਰ ਦਾ ਸੁਭਾਅ ਮੈਨੂੰ ਬਹੁਤ ਵਧੀਆ ਲੱਗਿਆ ਕਾਫ਼ੀ ਵੈਲਕੱਮ ਸੀਗੇ ਅਤੇ ਕਾਰ ਦਾ ਇੰਨਟੀਰੀਅਰ ਵੀ ਕਾਫ਼ੀ ਇੰਨਵਾਇਰਮੈਂਟ ਬਹੁਤ ਵਧੀਆ ਲੱਗਿਆ ਮੈਨੂੰ ਅਸੀਂ ਇੱਕ ਘੰਟੇ ਦਾ ਸਫ਼ਰ ਦੇ ਬਾਅਦ ਪਹੁੰਚੇ ਇਹ ਸਫ਼ਰ ਦੇ ਵਿੱਚ ਆਪਾਂ ਇੱਕ ਢਾਬੇ 'ਤੇ ਰੁਕੇ ਢਾਬੇ 'ਤੇ ਆਪਾਂ ਖਨ ਖਾਣਾ ਖਾਧਾ ਚਾਹ ਪੀਤੀ ਅਤੇ ਉੱਥੇ ਗੱਲਾਂ ਬਾਤਾਂ ਵੀ ਮਾਰੀਆਂ ਡਰਾਈਵਰ ਦਾ ਸੁਭਾਅ ਬਹੁਤ ਵਧੀਆ ਲੱਗਿਆ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਅ ਮੇਰੇ ਘਰ ਛੱਡ ਦਿੱਤਾ ਨਵਾਸ਼ਹਿਰ ਅਤੇ ਮੈਂ ਕ ਟੈਮ ਟੈਮ 'ਤੇ ਹੀ ਪਹੁੰਚ ਗਿਆ ਜਦ ਕਿ ਮੇਰੀ ਫੈਮਿਲੀ ਵੀ ਮੈਨੂੰ ਕਾਫ਼ੀ ਟੈ ਏ ਕਈ ਵਾਰ ਕੋਲ ਕਰਕੇ ਪੁੱਛ ਰਹੇ ਸੀ ਉਹਨਾਂ ਨੂੰ ਟੈਨਸ਼ਨ ਸੀ ਕਿ ਇਹ ਦੇਰ ਰਾਤ ਹੋ ਗਈ ਹੈ ਘਰ ਨਹੀਂ ਆਇਆ ਅਤੇ ਉਹ ਅਤੇ ਦੂਸਰੀ ਅੱਜ ਕੱਲ੍ਹ ਮਾਹੌਲ ਵੀ ਠੀਕ ਨਹੀਂ ਹੈ ਰਾਤ ਚੋਰੀ ਚਾਰੀ ਜਾਂ ਹੋਰ ਕੁਛ ਨੈਗੀਟਿਵ ਹੋ ਸਕਦਾ ਹੈ ਉਸ ਦੀ ਟੈਨਸ਼ਨ ਫਿਰ ਮੈਨੂੰ ਲੈਣੀ ਨਹੀਂ ਪਈ ਕਿਉਂਕਿ ਮੈਨੂੰ ਇਹ ਊਬਰ ਰਾਹੀਂ ਡਰਾਈਵਰ ਨੇ ਕਾਫ਼ੀ ਘੱਟ ਟ ਸਮੇਂ ਵਿੱਚ ਘਰ ਪਹੁੰਚਾ ਦਿੱਤਾ ਇਹ ਐਕਪੀਰੀਅਸ ਮੇਰੇ ਵਧੀਆ ਰਿਹਾ ਅਤੇ ਊਬਰ ਦਾ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਂ ਇਨ ਫਿਊਚਰ 'ਚ ਵੀ ਇਹਦਾ ਜ਼ਰੂਰ ਯੂਜ਼ ਕਰਨਾ ਚਾਹਾਵਾਂਗਾ ਬਹੁਤ ਬਹੁਤ ਥੈਂਕ ਯੂ